ਪੱਚੀ ਦਸੰਬਰ ਦੋ ਹਜ਼ਾਰ ਬਾਈ ਇੱਕ ਮਾਰਚ ਦੋ ਹਜ਼ਾਰ ਇੱਕ ਪੰਜ ਮਈ ਦੋ ਹਜ਼ਾਰ ਦਸ ਅੱਠ ਜੂਨ ਦੋ ਹਜ਼ਾਰ ਬਾਰਾਂ ਤੇਰਾਂ ਫਰਵਰੀ ਦੋ ਹਜ਼ਾਰ ਅਠਾਰਾਂ